ਭਾਰਤ ਦੀਆਂ ਬਾਈ ਸਰਕਾਰੀ ਭਾਸ਼ਾਵਾਂ ਹਨ ਜਿਹਨਾਂ ਨੂੰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਅਤੇ ਦੇਸ਼ ਵਿੱਚ ਆਮ ਬੋਲੀ ਜਾਣ ਵਾਲੀ ਭਾਸ਼ਾ ਹਿੰਦੀ ਹੈ ਅਤੇ ਇਹ ਦੇਸ਼ ਦੀ ਰਾਸ਼ਟਰੀ ਭਾਸ਼ਾ ਹੈ ਅਲੱਗ ਅਲੱਗ ਸੂਬਿਆਂ ਵਿੱਚ ਅਲੱਗ ਅਲੱਗ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਜਿਵੇਂ ਕਿ ਪੰਜਾਬ ਵਿੱਚ ਪੰਜਾਬੀ ਹਰਿਆਣਾ ਵਿੱਚ ਹਿੰਦੀ ਉੜੀਸਾ ਵਿੱਚ ਉੜੀਆ ਕਰਨਾਟਕ ਵਿੱਚ ਕੰਨੜ ਗੋਆ ਵਿੱਚ ਕੋਂਕਣੀ ਅਤੇ ਅੰਗਰੇਜ਼ੀ ਗੁਜਰਾਤ ਵਿੱਚ ਗੁਜਰਾਤੀ ਤਾਮਿਲਨਾਡੂ ਵਿੱਚ ਤਾਮਿਲ ਤੇਲੰਗਾਨਾ ਵਿੱਚ ਤੇਲਗੂ ਆਂਧਰਾ ਪ੍ਰਦੇਸ਼ ਵਿੱਚ ਤੇਲਗੂ ਅਤੇ ਉਰਦੂ ਪੱਛਮੀ ਬੰਗਾਲ ਵਿੱਚ ਬਾਂਗਲਾ ਤ੍ਰਿਪੁਰਾ ਵਿੱਚ ਬਾਂਗਲਾ ਅੰਗਰੇਜ਼ੀ ਮਣੀਪੁਰ ਵਿੱਚ ਮਣੀਪੁਰੀ ਮਹਾਰਾਸ਼ਟਰਾ ਵਿੱਚ ਮਰਾਠੀ ਕੇਰਲ ਵਿੱਚ ਮਲਿਆਲਮ ਮਿਜ਼ੋਰਮ ਵਿੱਚ ਮਿਜ਼ੋ ਬਿਹਾਰ ਵਿੱਚ ਹਿੰਦੀ ਛੱਤੀਸਗੜ੍ਹ ਵਿੱਚ ਹਿੰਦੀ ਮੱਧ ਪ੍ਰਦੇਸ਼ ਵਿੱਚ ਹਿੰਦੀ ਰਾਜਸਥਾਨ ਉੱਤਰ ਪ੍ਰਦੇਸ਼ ਉੱਤਰਾਖੰਡ ਝਾਰਖੰਡ ਇਹਨਾਂ ਸਾਰੇ ਸੂਬਿਆਂ ਵਿੱਚ ਹਿੰਦੀ ਬੋਲੀ ਜਾਂਦੀ ਹੈ